ਵਿਕਾ ਵਿਅਕਤੀਗਤ ਵਿਕਾਸ ਅਤੇ ਸਵੈ ਖੋਜ ਲਈ ਡਰਾਇੰਗ ਇੱਕ ਉੱਤਮ ਸਾਧਨ ਹੈ ਡਰਾਇੰਗ ਦੀ ਵਰਤੋਂ ਨਾਲ ਮੈਂ ਆਪਣੇ ਜੀਵਨ ਦੇ ਵਿੱਚ ਖੁਸ਼ੀ ਗਮੀ ਦਾ ਪ੍ਰਗਟਾਵਾ ਕਰ ਸਕਦਾ ਹਾਂ ਜਦੋਂ ਵੀ ਮੇਰੇ ਮਨ ਵਿੱਚ ਕਿਸੇ ਚੀਜ਼ ਦੀ ਕੋਈ ਇੱਛਾ ਹੋਵੇ ਤਾਂ ਡਰਾਇੰਗ ਦੀ ਵਰਤੋਂ ਕਰਕੇ ਮੈਂ ਉਸ ਇੱਛਾ ਨੂੰ ਪੂਰਾ ਕਰ ਸਕਦਾ ਹਾਂ ਜਿਵੇਂ ਮੇਰੀ ਅਸਮਾਨ ਵਿੱਚ ਉੱਡਣ ਦੀ ਇੱਛਾ ਹੋਵੇ ਤਾਂ ਮੈਂ ਪੰਛੀਆਂ ਦੀ ਡਰਾਇੰਗ ਬਣਾ ਕੇ ਉਸ ਵਿੱਚ ਆਪਣੀ ਇੱਛਾ ਨੂੰ ਪੂਰਾ ਕਰਦਾ ਹਾਂ ਜਾਂ ਜਿਵੇਂ ਮੇਰਾ ਕਿਸੇ ਪਹਾੜੀ ਇਲਾਕੇ ਵਿੱਚ ਜਾਣ ਦਾ ਮਨ ਕਰੇ ਤਾਂ ਮੈਂ ਪਹਾੜਾਂ ਦੀ ਡਰਾਇੰਗ ਬਣਾ ਕੇ ਆਪਣੇ ਮਨ ਨੂੰ ਸਮਝਾ ਲੈਂਦਾ ਹਾਂ ਜਿਵੇਂ ਕਿ ਮੇਰੇ ਨਾਲ ਇੱਕ ਇਸ ਤਰ੍ਹਾਂ ਹੋਇਆ ਜਦੋਂ ਮੈਨੂੰ ਬਹੁਤ ਖੁਸ਼ੀ ਹੋਈ ਤਾਂ ਮੈਂ ਉਸ ਨੂੰ ਡਰਾਇੰਗ ਦੁਆਰਾ ਬਹੁਤ ਵਧੀਆ ਬਣਾ ਕੇ ਉਸ ਖੁਸ਼ੀ ਦਾ ਇਜ਼ਹਾਰ ਕੀਤਾ ਉਸ ਵਿੱਚ ਮੈਂ ਵੱਖਰੇ ਵੱਖਰੇ ਤਰ੍ਹਾਂ ਦੇ ਡਾਂਸ ਵੱਖਰੇ ਵੱਖਰੇ ਤਰ੍ਹਾਂ ਦੇ ਫੋਕ ਸ ਗਾਣੇ ਗਾਣਿਆਂ ਨੂੰ ਇੱਕ ਡਰਾਇੰਗ ਦੇ ਫੋਰਮ ਦੇ ਵਿੱਚ ਬਣਾ ਕੇ ਦਰਸਾਇਆ ਅਤੇ ਉਸ ਵਿੱਚ ਮੈਨੂੰ ਆਪਣੇ ਆਪ ਨੂੰ ਬਹੁਤ ਚੰਗਾ ਲੱਗਾ ਅਤੇ ਇੱਕ ਵਾਰ ਮੈਂ ਆਪਣੀ ਡਰਾਇੰਗ ਦੇ ਵਿੱਚ ਦਰਖਤਾਂ ਦੀ ਡਰਾਇੰਗ ਬਣਾਈ ਕਿਉਂਕਿ ਮੈਨੂੰ ਦਰਖਤਾਂ ਨਾਲ ਬਹੁਤ ਪਿਆਰ ਹੈ ਇਸ ਲਈ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਮੈਂ ਆਪਣੇ ਮਨ ਦੀਆਂ ਗੱਲਾਂ ਡਰਾਇੰਗ ਨਾਲ ਪੂਰੀਆਂ ਕਰਦਾ ਹਾਂ